ਹਾਂਜੀ ਪੰਜਾਬ ਵਿੱਚ ਕਈ ਕਾਰੋਬਾਰ ਇੱਦਾਂ ਦੇ ਹੁੰਦੇ ਹਨ ਜਿਹਨਾਂ ਦੇ ਨਾਲ ਧੂੰਆਂ ਹੋਣ ਕਰਕੇ ਵਾਤਾਵਰਨ ਬਹੁਤ ਦੂਸ਼ਿਤ ਹੁੰਦਾ ਹੈ ਪੰਜਾਬ ਵਿੱਚ ਕਈ ਫੈਕਟਰੀਆਂ ਇੱਦਾਂ ਦੀ ਇੱਦਾਂ ਦੀਆਂ ਹੁੰਦੀਆਂ ਜਿਹਨਾਂ ਦੇ ਨਾਲ ਧੂੰਆਂ ਹੁੰਦਾ ਹੈ ਅਤੇ ਧੂੰਏ ਦੇ ਨਾਲ ਕਈ ਜਿ ਜਿਹੜੇ ਸਾਹ ਦੇ ਮਰੀਜ਼ ਹੁੰਦੇ ਹਨ ਉਹਨਾਂ ਨੂੰ ਬਹੁਤ ਔਖਾ ਹੁੰਦਾ ਹੈ ਸਾਹ ਦੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਬਹੁਤ ਦਿੱਕਤ ਹੁੰਦੀ ਹੈ ਅਤੇ ਜਿਵੇਂ ਕਿ ਖੇਤ ਦੇ ਵਿੱਚ ਪਰਾਲੀ ਵੀ ਕਈ ਲੋਕ ਸਾੜ ਦਿੰਦੇ ਹਨ ਸਾਨੂੰ ਸਾੜਨ ਦੀ ਬਜਾਏ ਪਰਾਲੀ ਨੂੰ ਖੇਤ ਦੇ ਵਿੱਚ ਹੀ ਟਰੈਕਟਰ ਦੇ ਨਾਲ ਵਾਹ ਕੇ ਸਾਨੂੰ ਉਸ ਦੇ ਨਾਲ ਪਰਾਲੀ ਸਾੜਨ ਦੀ ਬਜਾਏ ਵਾਹ ਟਰੈਕਟਰ ਦੇ ਨਾਲ ਵਾਹ ਕੇ ਸਾਨੂੰ ਖਾਦ ਵੀ ਤਿਆਰ ਹੋਈ ਮਿਲਦੀ ਹੈ ਅਤੇ ਇਸ ਦੇ ਨਾਲ ਕਿਸੇ ਨੂੰ ਧੂੰਏ ਨਾ ਧੂੰਆਂ ਹੋਵੇਗਾ ਅਤੇ ਨਾ ਹੀ ਸਾਹ ਦੇ ਮਰੀਜ਼ਾਂ ਦਾ ਮਰੀਜ਼ਾਂ ਨੂੰ ਔਖਾ ਹੋਵੇਗਾ ਅਤੇ ਸਾਨੂੰ ਖਾਦ ਹੋਏ ਤਿਆਰ ਹੋਈ ਵੀ ਮਿਲਦੀ ਹੈ ਧੰਨਵਾਦ ਜੀ